ਕਿਫਾਇਤੀ ਆਵਾਜਾਈ ਦੀ ਘਾਟ ਨੇ ਤਾਂ ਵੀ ਨੇੜਲੇ ਜਿਹੜੇ ਸ਼ਹਿਰ ਪਿੰਡ ਆ ਉੱਥੇ ਟਾਂਵੀ ਟਾਂਵੀ ਤਾਂ ਬੱਸ ਆਉਂਦੀ ਆ ਐਨੇ ਸਾਡੇ ਪਿੰਡਾਂ ਦੇ ਰੁਜ਼ਗਾਰ ਵਧੀਆ ਨਹੀਂ ਹੈਗੇ ਵੀ ਹਰੇਕ ਕੋਈ ਆਪਣਾ ਸਾਧਨ ਲੈ ਸਕੇ ਸਾਧਨ ਲੈ ਸਕੇ ਕਿਉਂਕਿ ਬੇਰੁਜ਼ਗਾਰੀ ਵੀ ਐਨੀ ਆ ਹੁਣ ਵੀ ਹਰੇਕ ਕੋਈ ਆਪਣਾ ਪਰਿਵਾਰ ਨੂੰ ਪਹਿਲਾਂ ਪਾਲਣਾ ਪੋਸ਼ਣਾ ਬੱਚਿਆਂ ਦਾ ਕਰਦਾ ਵੀ ਜਿਹੜੀਆਂ ਲੋੜਾਂ ਉਹ ਬਾਅਦ 'ਚ ਪੂਰੀਆਂ ਕਰਲਾਂਗੇ ਅਤੇ ਅੱਜ ਕੱਲ੍ਹ ਸਾਧਨ ਵੀ ਬੜੇ ਮਹਿੰਗੇ ਨੇ ਮਹਿੰਗੇ ਨੇ ਤਾਂ ਜੋ ਲੈ ਨਹੀਂ ਸਕਦਾ ਹਰੇਕ ਕੋਈ ਅਫੋਰਡ ਨਹੀਂ ਕਰ ਸਕਦਾ ਅਫੋਰਡ ਕਰਨਾ ਵੀ ਮੁਸ਼ਕਿਲ ਹੈ ਕਿਉਂਕਿ ਅੱਜ ਕੱਲ੍ਹ ਤਾਂ ਖਰਚੇ ਹੀ ਨਹੀਂ ਮੁੱਕਦੇ ਹੋਰ ਅਤੇ ਸਿਹਤ ਸੰਭਾਲ ਐਂ ਆ ਵੀ ਪਿੰਡਾਂ ਨੇੜਿਆਂ ਦੇ ਪਿੰਡਾਂ ਪਿੰਡਾਂ ਜੇ ਤੁਹਾਨੂੰ ਪਤਾ ਹੀ ਆ ਵੀ ਕੋਈ ਖਾਸ ਡਾਕਟਰ ਡੂਕਟਰ ਆਉਂਦਾ ਨਹੀਂ ਸੜਕਾਂ ਦਾ ਵੀ ਬੁਰਾ ਹੀ ਹਾਲ ਆ ਟਾਂਵੀ ਟਾਂਵੀ ਬੱਸ ਆਉਂਦੀ ਆ ਅਤੇ ਹਰੇ ਅਤੇ ਨਾ ਤਾਂ ਕੋਈ ਕੈਬ ਕੈਬ ਵੀ ਕਿਵੇਂ ਆਜੂੰਗੀ ਕਿਉਂਕਿ ਸੜਕਾਂ ਹੀ ਟੁੱਟੀਆਂ ਹੋਈਆਂ ਅਤੇ ਜੇ ਕੋਈ ਬਿਮਾਰ ਹੋ ਜਾਵੇ ਤਾਂ ਸ਼ਹਿਰ ਦੇ ਹਸਪਤਾਲ 'ਚ ਜਾਣਾ ਪੈਂਦਾ ਉੱਥੇ ਜਦ ਨੂੰ ਬੱਸ ਆਉਂਦੀ ਹੈ ਜਦ ਨੂੰ ਡਾਕਟਰਾਂ ਦੀ ਛੁੱਟੀ ਹੋ ਜ ਹੋ ਜਾਂਦੀ ਆ ਡਾਕਟਰਾਂ ਨੂੰ ਛੁੱਟੀ ਹੋ ਜਾਂਦੀ ਆ ਤਕਰੀਬਨ ਕਈ ਲੇਟ ਹੋ ਜਾਂਦੇ ਆ ਅਤੇ ਨੌਕਰੀ ਲਈ ਪੇਪਰ ਦੇਣ ਜਾਂਦੇ ਆ ਪੇਪਰ ਬਠਿੰਡੇ ਕੱਢਤਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਾਲਿਆਂ ਦਾ ਹੋਰ ਕਿਤੇ ਕੱਢਤਾ ਅਤੇ ਬਹੁਤ ਦਿੱਕਤ ਆਉਂਦੀ ਆ